ਭਾਅ ਜੀ ਢਿੱਲੋ ਕਾਰ ਏਜੰਸੀ ਤੋਂ ਬੋਲ ਰਹੇ ਹੋ ਜੀ ਹਾਂਜੀ ਨਮਸਕਾਰ ਜੀ ਮੈਂ ਰਾਜੀਵ ਸੁਖੀਜਾ ਬੋਲ ਰਿਹਾ ਮੈਂ ਨਾ ਪਰਸੋਂ ਤੁਹਾਡੀ ਕਾਰ ਲੈ ਕੇ ਗਿਆ ਸੀਗਾ ਜਿਹੜੀ ਤੁਸੀਂ ਕਾਰ ਟੈਕਸੀ ਸਰਵਿਸ ਦਿੰਦੇ ਹੋ ਪ੍ਰੋਵਾਈਡ ਕਰਦੇ ਹੋ ਉਹ 'ਚ ਸ਼ਾਮ ਲਾਲ ਦੀ ਗੱਡੀ ਸੀ ਜਿਹੜਾ ਡਰਾਈਵ ਕਰ ਰਿਹਾ ਸੀਗਾ ਤਾਂ ਮੈਨੂੰ ਅੱਛਾ ਨਹੀਂ ਲੱਗਿਆ ਜਿਹੜਾ ਕਾਰ ਜਿਹੜੀ ਹੈ ਨਾ ਇੱਕ ਤਾਂ ਕਾਰ ਜਿਹੜੀ ਬਾਹਰ ਛੋਟੀ ਕਾਰ ਭੇਜੀ ਇੱਕ ਤਾਂ ਤੁਸੀਂ ਇੱਕ ਦੂਜੇ ਜਿਹੜਾ ਨਾ ਕਾਰ ਦੀ ਜਿਹੜੀ ਬਾਹਰ ਆਊਟਲੁਕ ਸੀਗੀ ਉਹ ਵੀ ਸਫਾਈ ਚੰਗੀ ਤਰ੍ਹਾਂ ਨਹੀਂ ਹੋਈ ਹੋਈ ਸੀਗੀ ਮਿੱਟੀ ਉਹਦੇ 'ਚ ਚਮਕ ਰਹੀ ਸੀਗੀ ਸਾਫ ਲੱਗ ਰਿਹਾ ਸੀਗਾ ਵੀ ਦੋ ਦਿਨ ਤੋਂ ਧੋਤੀ ਨਹੀਂ ਹੋਈ ਸਾਫ ਨਹੀਂ ਕੀਤੀ ਫਿਰ ਜਦੋਂ ਅੰਦਰ ਬੈਠੇ ਤਾਂ ਸੀਟਸ ਬੜੀਆਂ ਗੰਦੀਆਂ ਸੀ ਕਿਉਂਕਿ ਪਹਿਲਾਂ ਕਿਤੇ ਡਰਾਈਵ ਕਰਕੇ ਗਿਆ ਹੋਣਾ ਉਹ ਬਿਨਾ ਸਾਫ ਕੀਤੇ ਹੀ ਕਾਰ ਸਾਡੇ ਕੋਲ ਪਹੁੰਚਾ ਦਿੱਤੀ ਗਈ ਉਹ 'ਚ ਪਿਛਲੀ ਸੀਟ 'ਤੇ ਇੰਨਾ ਗੰਦ ਬਿਖਰਿਆ ਪਿਆ ਸੀ ਚਿਪਸ ਦੇ ਪੈਕਟ ਪਏ ਸੀ ਬਿਸਕਿਟ ਪਏ ਸੀਗੇ ਰੈਪਰ ਪਏ ਸੀ ਪਾਣੀ ਦੀਆਂ ਦੋ ਖਾਲੀ ਬੋਤਲਾਂ ਉੱਥੇ ਗਿਰੀਆਂ ਪਈਆਂ ਅਤੇ ਉਹ ਵੀ ਈਵਨ ਚੱਕ ਕੇ ਫਿਰ ਡਰਾਈਵਰ ਨੂੰ ਮੈਂ ਮਤਲਬ ਰਿਕੁਐਸਟ ਕੀਤੀ ਵੀ ਸਫਾਈ ਕਰਕੇ ਸਾਨੂੰ ਫਿਰ ਬਿਠਾਓ ਇੱਥੇ ਤਾਂ ਡਰਾਈਵਰ ਕਹਿੰਦਾ ਜੀ ਫਿਰ ਤੁਹਾਨੂੰ ਲੇਟ ਹੋ ਜਾਊਗਾ ਜੀ ਫਿਰ ਮੈਂ ਸਫਾਈ ਕਰਵਾਉਣ ਗਿਆ ਤੁਸੀਂ ਇਸ ਤਰ੍ਹਾਂ ਹੀ ਬਾਹਰ ਸੁ ਉਹਨੇ ਚੱਕ ਕੇ ਨਾ ਉਹ ਸੁੱਟਤੀਆਂ ਅਤੇ ਇਸੇ ਤਰ੍ਹਾਂ ਹੀ ਫਿਰ ਸਾਨੂੰ ਬਿਠਾਤਾ ਮੈਂ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਉਹ ਮਤਲਬ ਕਿ ਬਹੁਤ ਵਧੀਆ ਗੱਡੀ ਨਹੀਂ ਲੱਗੀ ਮੈਨੂੰ ਨਾ ਅਤੇ ਪਹਿਲਾਂ ਤਿੰਨ ਚਾਰ ਵਾਰ ਪਹਿਲਾਂ ਵੀ ਮੈਂ ਤੁਹਾਡੀ ਗੱਡੀ ਲੈ ਗਿਆ ਅਤੇ ਉਹ 'ਚ ਮੈਨੂੰ ਕਦੇ ਐਸੀ ਸ਼ਿਕਾਇਤ ਹੋਈ ਨਹੀਂ ਫਸਟ ਟਾਈਮ ਮੈਨੂੰ ਲੱਗਿਆ ਵੀ ਇਹ ਠੀਕ ਨਹੀਂ ਹੈਗਾ ਤਾਂ ਮੈਂ ਸੋਚਿਆ ਚਲੋ ਪਹਿਲਾਂ ਇੱਕ ਵਾਰ ਤੁਹਾਡੇ ਨਾਲ ਗੱਲ ਕਰ ਲਾ ਮਤਲਬ ਮੈਨੂੰ ਡਰਾਈਵਰ ਦੀ ਤਾਂ ਕੋਈ ਕੰਪਲੇਂਟ ਨਹੀਂ ਹੈ ਕਾਰ ਦੀ ਕੰਪਲੇਂਟ ਆ ਵੀ ਜਿਹੜੀ ਕਾਰ ਸਰਵਿਸ ਜਿਹੜੀ ਸਾਫ ਸੁਥਰੀ ਕਾਰ ਨਹੀਂ ਸੀਗੀ ਬਸ ਇਹੀ ਬੇਨਤੀ ਸੀ ਜੀ ਓਕੇ ਜੀ ਥੈਂਕ ਯੂ